ਸਤਿ ਸ਼੍ਰੀ ਅਕਾਲ ਜੀ ਮੈਂ ਵਿਸ਼ਾਲੀ ਸ਼ਰਮਾ ਜ਼ਿਲ੍ਹਾ ਨਿਵਾਸੀ ਪਠਾਨਕੋਟ ਤੋਂ ਬੋਲ ਰਹੀ ਹਾਂ ਅੱਜ ਮੈਂ ਤੁਹਾਨੂੰ ਆਪਣੇ ਇੱਕ ਸ਼ੌਕ ਜੋ ਕਿ ਚਿੱਤਰਕਾਰੀ ਹੈ ਉਸਦੇ ਬਾਰੇ ਦੱਸਾਂਗੀ ਸਾਡੇ ਕਾਲਜ ਵਿੱਚ ਬੜੇ ਜ਼ਿਆਦਾ ਚਿੱਤਰਕਾਰੀ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਜਿਨ੍ਹਾਂ ਵਿੱਚ ਮੈਂ ਅਕਸਰ ਭਾਗ ਲੈਂਦੀ ਹਾਂ ਜਿਵੇਂ ਕਿ ਅੱਜ ਤੋਂ ਇੱਕ ਮਹੀਨਾ ਪਹਿਲਾਂ ਸਾਡੇ ਕਾਲਜ ਵਿੱਚ ਮੁਕਾਬਲਾ ਹੋਇਆ ਸੀ ਜਿਸਦੇ ਲਈ ਮੈਂ ਬੜੀ ਹੀ ਜ਼ਿਆਦਾ ਮਿਹਨਤ ਕੀਤੀ ਸੀ ਅਤੇ ਉਸ ਵਿੱਚ ਭਾਗ ਲਿਆ ਸੀ ਜੋ ਕਿ ਮੈਂ ਪ੍ਰਕ ਪ੍ਰਕਿਰਤੀ ਨਾਲ ਸੰਬੰਧਿਤ ਇੱਕ ਚਿੱਤਰ ਬਣਾਇਆ ਸੀ ਜੋ ਕਿ ਮੈਂ ਬਣਾਉਣ ਵਿੱਚ ਆਪਣੀ ਪੂਰੀ ਮਿਹਨਤ ਕੀਤੀ ਸੀ ਮੈਨੂੰ ਇਹ ਇਸ ਦਾ ਪਰਿਣਾਮ ਵੀ ਬਹੁਤ ਵਧੀਆ ਮਿਲਿਆ ਸੀ ਜਿਸ ਵਿੱਚ ਮੈਨੂੰ ਪਹਿਲਾਂ ਇਨਾਮ ਮਿਲਿਆ ਸੀ ਜਿਸਨੂੰ ਪਾ ਕੇ ਮੈਂ ਬਹੁਤ ਖੁਸ਼ ਹੋਈ ਅਤੇ ਮੈਂ ਤੁਹਾਨੂੰ ਵੀ ਕਹਿਣਾ ਚਾਹੁੰਦੀ ਹਾਂ ਕਿ ਜੇ ਤੁਸੀਂ ਵੀ ਕੋਈ ਸ਼ੌਕ ਰੱਖਦੇ ਹੋ ਤਾਂ ਤੁਸੀਂ ਵੀ ਉਸਨੂੰ ਪੂਰਾ ਕਰੋ ਧੰਨਵਾਦ